ਪਾਣੀ ਅਸੀਂ ਸਾਫ਼ ਰੱਖਣ ਲਈ ਪੈਪ ਡੂੰਘਾ ਪਾਇਆ ਆ ਅਤੇ ਪਾਣੀ ਨੂੰ ਸਾਫ਼ ਸਾਫ਼ ਰੱਖਣ ਲਈ ਪਾਣੀ ਦੀ ਬੱਚਤ ਕਰਨ ਲਈ ਕਿਸੇ ਭਾਂਡੇ ਵਿੱਚ ਭਰ ਕੇ ਰੱਖਦੇ ਹਾਂ ਅਸੀਂ ਪੀਣ ਵਾਲਾ ਪਾਣੀ ਸਾਫ਼ ਸੁਥਰਾ ਹੋਣਾ ਹੁੰਦਾ ਆ ਅਤੇ ਫਿਰ ਜਿਹੜੇ ਅਸੀ ਭਾਂਡੇ ਮਾਂਜਦੇ ਹਾਂ ਉਹ ਵੀ ਅਸੀਂ ਇੱਕ ਟੱਬ ਵਿੱਚ ਪਾ ਕੇ ਪਾਣੀ ਨਾ ਵੇਸਟ ਕਰੀਏ ਤਾਂ ਅਸੀਂ ਇੱਕ ਟੱਬ 'ਚ ਪਾ ਕੇ ਧੋਂਦੇ ਹਾਂ ਬਾਕੀ ਨਹਾਉਣ ਲਈ ਪਾਣੀ ਅਸੀਂ ਟੱਬ 'ਚ ਪਾ ਕੇ ਨਹਾਉਂਦੇ ਹਾਂ ਅਤੇ ਬਾਕੀ ਇਹ ਇਹ ਹੈ ਕਿ ਬਰਤਨ ਵਾਲਾ ਪਾਣੀ ਜੋ ਹੇਠਾਂ ਲੀਕਿੰਗ ਹੁੰਦੀ ਹੈ ਉਸ ਜਾ ਕੇ ਬੂਟਿਆਂ ਨੂੰ ਪਾਉਦੇ ਹਾਂ ਪਾਣੀ ਅਸੀਂ ਵੇਸਟ ਨਹੀਂ ਕਰਦੇ ਅਤੇ ਪਾਣੀ ਪਾਣੀ ਬਹੁਤ ਚੰ ਚੰਗੀ ਤਰ੍ਹਾਂ ਸੰਭਾਲ ਕਰਦੇ ਹਨ ਅਤੇ ਪਾਣੀ ਪੀਣ ਵਾਲਾ ਪਾਣੀ ਅਸੀਂ ਵਾਟਰਕੂਲਰ 'ਚ ਪਾ ਕੇ ਰੱਖਦੇ ਹਾਂ ਅਤੇ ਬਾਕੀ ਅਸੀਂ ਬੇਸਡ ਮੈਂ ਕਿਹਾ ਬੇਸਟ ਮੈਂ ਕਿਹਾ ਬਿਲਕੁਲ ਨਹੀਂ ਕਰਦੇ ਹੈਗੇ ਅਤੇ ਬਾਕੀ ਕੱਪੜੇ ਧੋਣ ਵਾਲਾ ਪਾਣੀ ਵੀ ਅਸੀਂ ਟੱਬ 'ਚ ਪਾ ਕੇ ਧੋਂਦੇ ਹਾਂ ਅਸੀਂ ਜ਼ਿਆਦਾ ਪਾਣੀ ਨਹੀਂ ਡੋਲਦੇ ਹੈਗੇ ਪਾਣੀ ਦੀ ਵਰਤੋਂ ਅਸੀਂ ਬਹੁਤ ਵੀ ਇੱਕ ਵਧੀਆ ਤਰੀਕੇ ਨਾਲ ਕਰਦੇ ਹਾਂ ਅਤੇ ਸਾਡੇ ਇੱਕ ਨਲਕਾ ਵੀ ਲੱਗਿਆ ਹੋਇਆ ਹੈ ਨਲਕੇ ਤੋਂ ਪਾਣੀ ਗੇੜ ਕੇ ਵੀ ਵਰਤਦੇ ਹਾਂ ਅਤੇ ਤਾਂ ਤਾਂ ਕਰਕੇ ਸਾਡੀ ਪਾਣੀ ਦੀ ਬੱਚਤ ਬਹੁਤ ਹੁੰਦੀ ਹੈਗੀ ਆ ਅਤੇ ਬਾਕੀ ਜਿਹੜਾ ਪਾਣੀ ਡੁੱਲਦਾ ਆ ਬਾਕੀ ਪੌਦਿਆਂ ਨੂੰ ਪਾ ਦਈਦਾ ਕਿ ਬਾਹਰ ਵੀ ਇੱਕ ਛਿੜਕਦੇ ਨਹੀਂ ਹਲਕਾ ਹਲਕਾ ਡੱਬੇ ਨਾਲ ਛਿੜਕ ਕੇ ਹੀ ਅਸੀਂ ਕੰਮ ਕਰਦੇ ਹਨ ਅਤੇ ਬਾਕੀ ਹੋਰ ਵੀ ਇੱਕ ਪਾਣੀ ਦੀ ਬਹੁਤ ਸੰਭਾਲ ਕਰਦੇ ਹਾਂ